ਹਾਂਜੀ ਸਤਿ ਸ਼੍ਰੀ ਅਕਾਲ ਜੀ ਆਧੁਨਿਕ ਯੁੱਗ ਵਿੱਚ ਬਹੁਤ ਸਾਰੇ ਆਵਾਜਾਈ ਦੇ ਸਾਧਨ ਜਿਹੜੇ ਆ ਉਹ ਵੱਧ ਗਏ ਆ ਅਤੇ ਆਵਾਜਾਈ ਦੇ ਸਾਧਨਾਂ ਦੇ ਮਨੁੱਖ ਦੀ ਜ਼ਿੰਦਗੀ 'ਤੇ ਬਹੁਤ ਹੀ ਚੰਗਾ ਪ੍ਰਭਾਵ ਪਿਆ ਵਾ ਮਨੁੱਖ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਯਾਤਰਾ ਕਰਨ ਵਿੱਚ ਜਿਹੜੀ ਆ ਉਹ ਬਹੁਤ ਆਸਾਨੀ ਹੋਈ ਆ ਠੀਕ ਹੈ ਜਿਵੇਂ ਪਹਿਲਾਂ ਲੋਕਾਂ ਕੋਲ ਘੋੜੇ ਹੁੰਦੇ ਸੀ ਜਾਂ ਫਿਰ ਥੋੜ੍ਹਾ ਊਠਾਂ 'ਤੇ ਜਾਂਦੇ ਸੀ ਥੋੜ੍ਹਾ ਸਮਾਂ ਬਦਲਣ ਨਾਲ ਸਾਈਕਲ ਆ ਗਏ ਠੀਕ ਹੈ ਫਿਰ ਵੀ ਬਹੁਤ ਸਾਰਾ ਸਮਾਂ ਲੱਗਦਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ ਲਈ ਪਰ ਜਿਵੇਂ ਜਿਵੇਂ ਸਮਾਂ ਬਦਲ ਗਿਆ ਆਵਾਜਾਈ ਦੇ ਸਾਧਨਾਂ ਵਿੱਚ ਵੀ ਵਾਧਾ ਹੁੰਦਾ ਗਿਆ ਅਤੇ ਕਈ ਤਰ੍ਹਾਂ ਦੇ ਨਵੇਂ ਨਵੇਂ ਸਾਧਨ ਜਿਹੜੇ ਆ ਉਹ ਸਾਡੇ ਸਾਹਮਣੇ ਆਉਂਦੇ ਗਏ ਅਤੇ ਜਿਨ੍ਹਾਂ ਨੇ ਦੂਰੀ ਨੂੰ ਜਿਹੜਾ ਵਾ ਉਹ ਘੱਟ ਕਰ ਦਿੱਤਾ ਹੁਣ ਕਈ ਕਿਲੋਮੀਟਰਾਂ ਦਾ ਸਫ਼ਰ ਜਿਹੜਾ ਵਾ ਇਨਸਾਨ ਘੰਟਿਆਂ ਦੋ ਘੰਟਿਆਂ ਵਿੱਚ ਜਿਹੜਾ ਵਾ ਉਹ ਤੈਅ ਕਰ ਲੈਂਦਾ ਪਹਿਲਾਂ ਜਿਹੜਾ ਸੀ ਇਹ ਸਫ਼ਰ ਤੈਅ ਕਰਨਾ ਬੜਾ ਔਖਾ ਲੱਗਦਾ ਸੀ ਠੀਕ ਹੈ ਪੈਦਲ ਜਾਣਾ ਜਾਂ ਸਾਈਕਲਾਂ 'ਤੇ ਜਾਣਾ ਅਤੇ ਬਹੁਤ ਸਮਾਂ ਚਾਹੀਦਾ ਹੁੰਦਾ ਸੀ ਅੱਜ ਦੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਮਤਲਬ ਪਦਾਰਥਵਾਦੀ ਹੋ ਗਏ ਆਂ ਜਾਂ ਫਿਰ ਇੱਦਾਂ ਕਹਿ ਲਓ ਕਿ ਲੋਕਾਂ ਦੇ ਕਾਰਜ ਜਿਵੇਂ ਇੰਨੇ ਕੁ ਜ਼ਿਆਦਾ ਵੱਧ ਗਏ ਆ ਕਿ ਉਹਨਾਂ ਕੋਲ ਸਮੇਂ ਦੀ ਜਿਹੜੀ ਆ ਉਹ ਬੜੀ ਕਮੀ ਆ ਅਤੇ ਸਮੇਂ ਦੀ ਇਸ ਕਮੀ ਨੂੰ ਜਿਹੜਾ ਵਾ ਪੂਰਾ ਮਤਲਬ ਜਿਵੇਂ ਕਮੀ ਹੈਗੀ ਆ ਅਤੇ ਇਨਸਾਨ ਜਦੋਂ ਇੱਕ ਜਗ੍ਹਾ ਦੂਜੀ ਜਗ੍ਹਾ ਜਾਂਦਾ ਜੇ ਪਹਿਲਾਂ ਦੀ ਤਰ੍ਹਾਂ ਸਮਾਂ ਲੱਗਦਾ ਹੋਵੇ ਤਾਂ ਉਹ ਤਾਂ ਕਿਸੇ ਨਾਲ ਮੇਲ ਲਾਪ ਰੱਖ ਹੀ ਨਾ ਸਕੇ ਪਰ ਹੁਣ ਅੱਜ ਕੱਲ੍ਹ ਦੀਆਂ ਗੱਡੀਆਂ ਮੋਟਰਸਾਈਕਲ ਠੀਕ ਆ ਕਾਰਾਂ ਨੇ ਇਨ੍ਹਾਂ ਸਾਰਿਆਂ ਨੇ ਜਿਹੜਾ ਵਾ ਉਹ ਦੂਰੀ ਨੂੰ ਘਟਾ ਦਿੱਤਾ ਵਾ ਅਤੇ ਹੁਣ ਇਸ ਵਕਤ ਵਿੱਚ ਕਈ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਜਿਹੜੇ ਉਪਲੱਬਧ ਆ ਜਿਵੇਂ ਰੇਲਾਂ ਅਤੇ ਕਈ ਸਾਧਨ ਤਾਂ ਹੁਣ ਇੱਦਾਂ ਦੇ ਆ ਜਿਹੜੇ ਸਾਨੂੰ ਇੱਕ ਦੇਸ਼ ਤੋਂ ਸਮੁੰਦਰ ਪਾਰ ਕਰਾ ਕੇ ਦੂਜੇ ਦੇਸ਼ 'ਚ ਪਹੁੰਚਾ ਦਿੰਦੇ ਆ ਜਿਵੇਂ ਜਹਾਜ਼ ਠੀਕ ਆ ਹਵਾਈ ਜਹਾਜ਼ ਇਹ ਸਾਰਾ ਕੁਛ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਸਾਰੇ ਸਾਧਨਾਂ ਨੇ ਜਿਹੜਾ ਵਾ ਮਨੁੱਖ ਦੀ ਜ਼ਿੰਦਗੀ ਨੂੰ ਬਹੁਤ ਹੀ ਜ਼ਿਆਦਾ ਸੌਖਾ ਕਰ ਦਿੱਤਾ ਵਾ ਇਹ ਜਿਹੜੀ ਢੰਗ ਆ ਗਏ ਆਵਾਜਾਈ ਦੇ ਨਵੇਂ ਨਵੇਂ ਇਹ ਪਹਿਲੇ ਸਮੇਂ ਵਿੱਚ ਨਹੀਂ ਹੁੰਦੇ ਸੀ ਹੁਣ ਅਤੇ ਜਿਹੜਾ ਵਾ ਬੰਦਾ ਇੱਕ ਦਿਨ ਵਿੱਚ ਕਈ ਕੋਹਾਂ ਜਿਹੜਾ ਵਾ ਉਹ ਪੂਰਾ ਸਫ਼ਰ ਤੈਅ ਕਰ ਸਕਦਾ ਵਾ ਇਹ ਕਈ ਕਈ ਪਹਿਲੇ ਸਮੇਂ 'ਚ ਲੋਕ ਜਦੋਂ ਕੁੜੀਆਂ ਦੇ ਰਿਸ਼ਤੇ ਕਰਦੇ ਹੁੰਦੇ ਸੀ ਤਾਂ ਦੂਰ ਕਰਨ ਤੋਂ ਡਰਦੇ ਹੁੰਦੇ ਸੀ ਕਿ ਛੇ ਛੇ ਮਹੀਨਿਆਂ ਬਾਅਦ ਕਿਵੇਂ ਵਿਚਾਰੀਆਂ ਮਿਲਣ ਆਇਆ ਕਰਨਗੀਆਂ ਔਖਾ ਹੋ ਜਾਂਦਾ ਸੀ ਅੱਜ ਕੱਲ੍ਹ ਜਿਹੜਾ ਵਾ ਇਹ ਚੀਜ਼ ਘੱਟ ਗਈ ਆ ਕਿਉਂਕਿ ਗੱਡੀਆਂ ਸਾਰਿਆਂ ਦੇ ਕੋਲ ਆ ਅਤੇ ਜਿਹੜਾ ਇੱਕ ਜਿਹੜਾ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਣਾ ਕੋਈ ਔਖਾ ਹੀ ਨਹੀਂ ਹੈ ਬਿਲਕੁਲ ਸੌਖਾ ਹੈਗਾ ਵਾ ਆਰਾਮ ਨਾਲ ਜਿਹੜਾ ਵਾ ਉਹ ਇੱਕ ਦੂਜੇ ਨੂੰ ਮਿਲ ਕੇ ਅਤੇ ਸ਼ਾਮ ਨੂੰ ਆਪਣੇ ਘਰ ਵਾਪਿਸ ਵੀ ਆ ਸਕਦੇ ਆ ਇਸ ਲਈ ਮੈਂ ਇਹ ਕਹੂੰਗੀ ਕਿ ਆਵਾਜਾਈ ਦੇ ਸਾਧਨਾਂ ਦੀ ਮਨੁੱਖ ਦੀ ਜ਼ਿੰਦਗੀ 'ਤੇ ਬਹੁਤ ਹੀ ਜ਼ਿਆਦਾ ਸਕਾਰਾਤਮਕ ਜਿਹੜਾ ਵਾ ਉਹ ਪ੍ਰਭਾਵ ਪਾਇਆ ਵਾ ਅਤੇ ਆਵਾਜਾਈ ਨੇ ਦੂਰੀ ਘਟਾਤੀ ਆ ਅਤੇ ਜਿਹੜਾ ਵਾ ਦੂਰੀ ਘਟਣ ਦੇ ਨਾਲ ਵੀ ਬਚਿਆ ਵਾ ਅਤੇ ਲੋਕਾਂ ਕੋਲ ਆਪਣਾ ਕੰਮ ਕਰਨ ਲਈ ਬਹੁਤ ਸਾਰਾ ਸਮਾਂ ਜਿਹੜਾ ਵਾ ਉਹ ਬਚ ਜਾਂਦਾ ਹੈ ਧੰਨਵਾਦ